ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਮਨੀ ਕਮਿਊਨੀਕੇਸ਼ਨ ਤੋਂ ਬੋਲਦੇ ਹੋ ਮੈਂ ਤੁਹਾਡੇ ਸ਼ੋਪ ਪਰ ਤੋਂ ਇੱਕ ਫ਼ੋਨ ਔਡਰ ਕੀਤਾ ਸੀ ਰੈਡਮੀ ਫ ਰੈਡਮੀ ਨਾਈਨ ਅਤੇ ਮੈਨੂੰ ਉਸਦੀ ਡਿਲੀਵਰੀ ਬਹੁਤ ਲੇਟ ਮਿਲੀ ਹੈ ਅਤੇ ਜਦੋਂ ਮਿਲੀ ਹੈ ਤਾਂ ਉਹ ਬਹੁਤ ਬਹੁਤ ਬੇਕਾਰ ਹਾਲਤ ਵਿੱਚ ਸੀ ਉਸਦਾ ਡੱਬਾ ਬਹੁਤ ਖ਼ਰਾਬ ਸੀ ਫ਼ੋਨ ਵੀ ਇੱਦਾਂ ਲੱਗਦਾ ਸੀ ਕਿ ਜਿਵੇਂ ਕੋਈ ਪੁਰਾਣਾ ਫ਼ੋਨ ਦਿੱਤਾ ਹੁੰਦਾ ਹੈ ਅਤੇ ਫਿਰ ਇਸ ਇਹ ਫ਼ੋਨ ਬਹੁਤ ਹੈਂਗ ਹੁੰਦਾ ਹੈ ਇਸ 'ਚ ਫੋਟੋ ਵੀ ਕਲੀਅਰ ਨਹੀਂ ਆਉਂਦੀ ਇਸ 'ਚ ਆਵਾਜ਼ ਵੀ ਬਹੁਤ ਘੱਟ ਸੁਣਦੀ ਹੈ ਇਸ ਦਾ ਗਲਾਸ ਵੀ ਵਧੀਆ ਨਹੀਂ ਹੈਗਾ ਇਹ ਇਸ 'ਚ ਬੈਟਰੀ ਵੀ ਬਹੁਤ ਜਾਂਦੀ ਹੈ ਇਸਦਾ ਬੈਟਰੀ ਬੈਕਅੱਪ ਨਹੀਂ ਵਧੀਆ ਨਹੀਂ ਹੈਗਾ ਤੁਸੀਂ ਮੈਨੂੰ ਫ਼ੋਨ ਜਾਂ ਤਾਂ ਚੇਂਜ ਕਰਕੇ ਦੇ ਦਿਓ ਜਾਂ ਫਿਰ ਇਸਨੂੰ ਠੀਕ ਕਰਵਾ ਕੇ ਦੇ ਦਿਓ ਮੈਂ ਇਹ ਫ਼ੋਨ ਨਹੀਂ ਰੱਖਣਾ ਚਾਹੁੰਦੀ ਥੈਂਕ ਯੂ